ਹਾਂਜੀ ਦਿਵਜੋਤ ਮੈਮ ਬੋਲਦੇ ਹੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਆਪਣੇ ਬੇਟੇ ਬਾਰੇ ਜਸਪ੍ਰੀਤ ਸਿੰਘ ਬਾਰੇ ਪੁੱਛਣਾ ਸੀ ਏਟਥ ਕਲਾਸ ਵਿੱਚ ਹੈ ਬੇ ਮੇਰਾ ਬੇਟਾ ਅਤੇ ਸੋਰੀ ਨਹੀਂ ਮੈਮ ਸੋਰੀ ਸਾਡੇ ਤੋਂ ਆਇਆ ਨਹੀਂ ਗਿਆ ਜੀ ਸਾਨੂੰ ਕੰਮ ਪੈ ਗਿਆ ਸੀ ਜ਼ਰੂਰੀ ਅਤੇ ਫੇ ਮੈਂ ਅੱਜ ਬੱਚੇ ਬਾਰੇ ਪੁੱਛਣਾ ਸੀ ਵੀ ਉਹਦੇ ਨੰਬਰ ਕਿਸ ਤਰ੍ਹਾਂ ਰਹੇ ਫਸਟ ਯੂਨਿਟ ਦੇ ਰਿਜਲਟ ਅਤੇ ਉਹਦਾ ਕਿਸ ਤਰ੍ਹਾਂ ਦਾ ਰਿਹਾ ਉਹਦੇ ਸਬਜੈਕਟ ਮੈਨੂੰ ਨੰਬਰ ਦੱਸੋਂਗੇ ਕਿੰਨੇ ਆਏ ਆ ਉਹਦੇ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂ ਅੱਛਾ ਜੀ ਮੈਮ ਐਤਕੀ ਅਸੀਂ ਮੈਥ 'ਤੇ ਫਿਰ ਜ਼ਿਆਦਾ ਜੋਰ ਦਿੱਤਾ ਸੀ ਇਹਦੇ ਮਤਲਬ ਐਕਸਟਰਾ ਕਲਾਸਿਸ ਲਵਾਈਆਂ ਤਾਂ ਵਧੀ ਫਿਰ ਤਾਂ ਹੀ ਇਹਨੇ ਵਧੀਆ ਨੰਬਰ ਲੈ ਗਿਆ ਇੱਨੇ ਮਿਹਨਤ ਬੜੀ ਕੀਤੀ ਐਤਕੀ ਅਤੇ ਅੱਛਾ ਜੀ ਅੱਛਾ ਅੱਛਾ ਅੱਛਾ ਅੱਛ ਅੱਛਾ ਅੱਛਾ ਜੀ ਅਤੇ ਅੱਛਾ ਜੀ ਅੱਛਾ ਜੀ ਅਤੇ ਮੈਮ ਅੱਛਾ ਜੀ ਹਾਂਜੀ ਹਾਂਜੀ ਹਾਂ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਵੀ ਚਲੋ ਅੱਗੇ ਤੋਂ ਹੈ ਨਾ ਸਾਇੰਸ ਅਤੇ ਐੱਸ ਐੱਸ ਟੀ ਚੋਂ ਵੀ ਵਧੀਆ ਲਵੇ ਵੀ ਸਾਰੇ ਸਬਜੈਕਟਾਂ ਵੱਲ ਕੋਸ਼ਿਸ਼ ਕਰਾਂਗੇ ਵੀ ਧਿਆਨ ਦਿੱਤਾ ਜਾਵੇ ਹਾਂਜੀ ਹਾਂਜੀ ਹਾਂ ਚਲੋ ਸ਼ੁਕਰ ਹਾਂਜੀ ਠੀਕ ਹੈ ਜੀ ਧੰਨਵਾਦ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਦੋਂ ਹੁਣ ਫਾਈਨਲ ਪੇਪਰ ਜ ਆਉਣਗੇ ਨਾ ਵੀ ਉਦੋਂ ਤੱਕ ਇਹਦੀ ਵਧੀਆ ਤਿਆਰੀ ਕਰਾ ਦਿੱਤੀ ਜਾਵੇ ਵੀ ਕੋਈ ਹਾਂਜੀ ਹਾਂਜੀ ਹਾਂ

ਅੱਛਾ ਜੀ ਨਹੀਂ ਕੋਈ ਗੱਲ ਨਹੀਂ ਮੈਮ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਵੀ ਕਿਉਂਕਿ ਗੇਮ ਵੀ ਜ਼ਰੂਰੀ ਹੈ ਅਤੇ ਪ ਪੜ੍ਹਾਈ ਵੀ ਜ਼ਰੂਰੀ ਹਾਂਜੀ ਹਾਂਜੀ ਹਾਂਜੀ ਹਾਂ ਉਂਝ ਮੈਮ ਇਹ ਕਲਾਸ ਦੇ ਵਿੱਚ ਕਿਸ ਤਰ੍ਹਾਂ ਬਾਕੀ ਬੱਚਿਆਂ ਨਾਲ ਠੀਕ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਨਹੀਂ ਅਸੀਂ ਜਦੋਂ ਮਤਲਬ ਅੱਗੇ ਤੋਂ ਇਹਨੂੰ ਇੱਕ ਗੇਮ ਦਾ ਪੀਰੀ ਮਤਲਬ ਗੇਮ ਵੀ ਦਵਾਵਾਂਗੇ ਤਾਂ ਕਿ ਵੀ ਅੱਗੇ ਤੋਂ ਵਧੀਆ ਨੰਬਰ ਵੀ ਲਵੇ ਅਤੇ ਇਹਦਾ ਕੋਨਫੀਡੈਂਸ ਵੀ ਵਧੇ ਹਾਂਜੀ ਹਾਂ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ ਓਕੇ